ਹਾਂਜੀ ਪਿਛਲੇ ਸਮੇਂ ਦੀ ਸਿਲਾਈ ਕਢਾਈ ਤਾਂ ਹੱਥ ਨਾ ਕੀਤੀ ਜਾਂਦੀ ਸੀਗੀ ਪਰ ਜਿੱਦਾਂ ਕਿ ਹੋਇਆ ਸੂਈ ਦੇ ਸੂਈ ਦੇ ਨਾਲ ਕੰਮ ਕੀਤਾ ਜਾਂਦਾ ਸੀਗਾ ਅਤੇ ਹੁਣ ਅੱਜ ਕੱਲ੍ਹ ਦਾ ਸਮਾਂ ਤਾਂ ਇੱਦਾਂ ਦਾ ਆ ਗਿਆ ਕਿ ਅਗਾਂਹ ਅਗਾਂਹ ਬਹੁਤ ਤਰੱਕੀ ਹੋ ਗਈ ਹੈ ਪਿੱਛੇ ਤਾਂ ਹੱਥ ਨਾਲ ਸੂਟ ਸਿਲਾਈ ਕਰਦੇ ਸੀ ਹੁਣ ਮੋਟਰ 'ਤੇ ਕਰਦੇ ਨੇਗੇ ਮੋਟਰ ਲੱਗੀ ਆ ਸਿਲਾਈ ਮਸ਼ੀਨਾਂ 'ਤੇ ਹੁਣ ਮਸ਼ੀਨ ਵੀ ਅਗਾਂਹ ਇੱਕ ਉੱਤੇ ਇੱਕ ਇੱਕ ਤੋਂ ਵੱਧ ਰਹੀ ਹੈ ਅਤੇ ਬਾਕੀ ਕੰਪਿਊਟਰ ਵਾਲੀਆਂ ਆ ਗਈਆਂ ਨੇ ਮਸ਼ੀਨਾਂ ਕੰਪਿਊਟਰ 'ਤੇ ਕਢਾਈਆਂ ਹੁੰਦੀਆਂ ਹਨ ਅਤੇ ਬਾਕੀ ਹੋਰ ਉਹਦੇ ਨਾਲ ਆਰਕੰਡੀ ਵਾਲੀ ਵੀ ਕਢਾਈ ਹੁੰਦੀ ਹੈ ਅੱਡੇ 'ਤੇ ਲਾ ਕੇ ਵੀ ਕਢਾਈਆਂ ਕੱਢਦੇ ਨੇਗੇ ਅਤੇ ਪੁਰਾਣੇ ਸਮੇਂ ਤੋਂ ਬਹੁਤ ਬਦਲਾਅ ਆ ਗਿਆ ਹੈ ਅਤੇ ਹੁਣ ਤਾਂ ਬਹੁ ਬਹੁਤ ਵਧੀਆ ਕੰਮ ਚੱਲਦਾ ਆ ਅਤੇ ਜਿੰ ਜਿੰਨਾ ਜਿੰਨਾ ਮਰਜ਼ੀ ਤੁਸੀਂ ਕੰਮ ਕਰ ਸਕਦੇ ਹੋ ਅਤੇ ਬਸ ਇਹ ਹੀ ਇਹ ਹੀ ਆ ਕਿ ਪਹਿਲਾਂ ਵਾਲੇ ਸਮੇਂ ਨੂੰ ਹੁਣ ਵਾਲੇ ਵਿੱਚ ਬਹੁਤ ਜ਼ਿਆਦਾ ਚੇਂਜ ਅਤੇ ਬਹੁਤ ਜ਼ਿਆਦਾ ਬਦਲਾਅ ਆ ਗਿਆ